ਪਰਿਵਾਰ ਵਿੱਚ ਬਾਗਬਾਨੀ ਦਾ ਜੋ ਦਿਲਚਸਪੀ ਹੈ ਇਹ ਪਹਿਲਾਂ ਤੋਂ ਹੀ ਸਾਡੇ ਪਰਿਵਾਰ ਵਿੱਚ ਕਾਫੀ ਦੇਰ ਤੋਂ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਉਦੋਂ ਤੋਂ ਹੀ ਹੈ ਫੁੱਲ ਬੂਟੇ ਲਾਉਣਾ ਸਾਡਾ ਸ਼ੌਂਕ ਹੈ ਜਦੋਂ ਹੁਣ ਮੇਰੇ ਸਮੇਂ ਦੇ ਵਿੱਚ ਮੈਂ ਤਕਰੀਬਨ ਸੋਲ੍ਹਾਂ ਫਲਾਂ ਦੇ ਬੂਟੇ ਲਗਾਏ ਹੋਏ ਹਨ ਅਤੇ ਉਸਦੇ ਵਿੱਚ ਹੀ ਸਬਜ਼ੀ ਵਗੈਰਾ ਜੋ ਵੀ ਪਿਆਜ ਹੋ ਗਿਆ ਲਸਣ ਹੋ ਗਿਆ ਜੋ ਵੀ ਹੈ ਬਾਗਬਾਨੀ ਦਾ ਉਹ ਮੈਂ ਆਪ ਦੇਖਦਾ ਹਾਂ ਜਦੋਂ ਮੈਂ ਘਰ ਵਿੱਚ ਨਹੀਂ ਹੁੰਦਾ ਤਾਂ ਮੇਰੇ ਪਿੱਛੋਂ ਮੇਰਾ ਪਰਿਵਾਰ ਹੈ ਜਿਹੜਾ ਉਹ ਬਾਗਬਾਨੀ ਸੰਭਾਲਦਾ ਹੈ ਪਾਣੀ ਲਾਉਣਾ ਖਾਦ ਪਾਉਣੀ ਜੋ ਵੀ ਕਰਨਾ ਹੈ ਉਹ ਮੇਰੇ ਤੋਂ ਵਾ ਇਲਾਵਾ ਮੇਰਾ ਪਰਿਵਾਰ ਮੇਰਾ ਮੇਰੇ ਬੱਚੇ ਹਨ ਗੁੜੀਆ ਬੇਟਾ ਉਹ ਦੇਖਦੇ ਹਨ ਕਿਉਂਕਿ ਸਾਡੇ ਘਰ ਦੇ ਵਿੱਚ ਸਾਰੇ ਪਰਿਵਾਰ ਨੂੰ ਹੀ ਬਾਗਬਾਨੀ ਦਾ ਸ਼ੌਂਕ ਹੈ ਬੂਟਿਆਂ ਦੀ ਦੇਖ ਭਾਲ ਕਰਨਾ ਗੋਡੀ ਕਰਨੀ ਖਾਦ ਪਾਉਣੀ ਸਮੇਂ ਸਿਰ ਪਾਣੀ ਲਾਉਣਾ ਜੋ ਵੀ ਹੈ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਹੀ ਇਸ ਦਾ ਸ਼ੌਂਕ ਹੈ ਮੇ ਮੇਰੇ ਤੋਂ ਬਾਅਦ ਮੇਰੇ ਬੱਚੇ ਹਨ ਜੋ ਇਸ ਬਾਗਬਾਨੀ ਨੂੰ ਸੰਭਾਲਦੇ ਹਨ ਦੇ ਬਾਗਬਾਨੀ ਇੱਕ ਰੂਹ ਦੀ ਖ਼ੁਰਾਕ ਹੈ ਜਦੋਂ ਬੰਦਾ ਫਰੀ ਹੁੰਦਾ ਹੈ ਉਦੋਂ ਬਾਗਬਾਨੀ ਵਿੱਚ ਉਹਦਾ ਦਿਲ ਲੱਗਿਆ ਰਹਿੰਦਾ ਹੈ ਜਿਸ ਕਾਰਨ ਜਿਹੜਾ ਬ ਬੰਦੇ ਦਾ ਸਮਾਂ ਹੈ ਉਹ ਵਧੀਆ ਗੁਜ਼ਰਦਾ ਹੈ